ਗਾਉਣ ਵਿੱਚ ਸੰਗੀਤ ਦੀ ਮੈਨੂੰ ਲੋਕ ਗੀਤ ਬ ਮੈਨੂੰ ਬਹੁਤ ਪਸੰਦ ਹੈ ਜੋ ਗੀਤ ਪੁਰਾਣੇ ਜ਼ਮਾਨੇ ਹੁ ਦੇ ਹੁੰਦੇ ਹਨ ਉਹ ਗੀਤ ਮੈਨੂੰ ਬਹੁਤ ਵਧੀਆ ਲੱਗਦੇ ਹਨ ਉਹਨਾਂ ਨੂੰ ਗਾਉਣ ਵਿੱਚ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਕਿਸੇ ਦਾ ਵਿਆਹ ਵਿਆਹ ਸ਼ਾਦੀ ਹੁੰਦਾ ਹੈ ਤਾਂ ਅਸੀਂ ਆਸ ਗੁਆਂਢ ਦੀਆਂ ਬੁੜੀਆਂ ਇਕੱਠੀਆਂ ਹੋ ਕੇ ਲੋਕ ਗੀਤ ਵਿੱਚ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਹਨ ਕਿਉਂਕਿ ਇਹ ਗੀਤ ਪੁਰਾਣੇ ਸਮੇਂ ਨਾਲ ਸਬੰਧ ਰੱਖਦੇ ਹਨ ਅਤੇ ਮੈਨੂੰ ਇਹ ਗੀਤ ਗਾਉਣ ਵਿੱਚ ਬਹੁਤ ਸਕੂਨ ਮਿਲਦਾ ਹੈ ਢੋਲਕੀ 'ਤੇ ਵੀ ਗੀਤ ਗਾਉਣੇ ਬਹੁਤ ਪਸੰਦ ਹਨ